ਤਕਨਾਲੋਜੀ ਨੇ ਮੰਨੋਰੰਜਨ 'ਤੇ ਵੀ ਬਹੁਤ ਵੱਡਾ ਪ੍ਰਭਾਵ ਪਾਇਆ ਹੈ ਕਿਉਂਕਿ ਪਹਿਲਾਂ ਪਹਿਲ ਲੋਕ ਮੇਲਾ ਦੇਖਣ ਜਾਂਦੇ ਸਨ ਫਿਲਮ ਦੇਖਣ ਜਾਂਦੇ ਸਨ ਅਤੇ ਚਿੱਟੇ ਪਰਦੇ 'ਤੇ ਫਿਲਮ ਦੇਖਦੇ ਸਨ ਅਤੇ ਇਕੱਠੇ ਹੋ ਕੇ ਜਾਂ ਫਿਰ ਇਕੱਠੇ ਹੋ ਕੇ ਘਰ ਵਿੱਚ ਬੈਠ ਕੇ ਟੈਲੀਵਿਜ਼ਨ ਵਿੱਚ ਫਿਲਮ ਦੇਖਦੇ ਸਨ ਪਰ ਅੱਜਕੱਲ੍ਹ ਹਰ ਕਿਸੇ ਕੋਲ ਆਪਣਾ ਫੋਨ ਹੈ ਅਤੇ ਹਰ ਕੋਈ ਆਪਣਾ ਕਮਰੇ ਵਿੱਚ ਬੈਠ ਕੇ ਇਕੱਲੇ ਵੀਡੀਓ ਦੇਖਦਾ ਹੈ ਅਤੇ ਗਾਣੇ ਸੁਣਦਾ ਹੈ ਪਰ ਪਹਿਲਾਂ ਇਸ ਨਾਲ ਨਿੱਜੀ ਸੰਬੰਧ ਵੀ ਘੱਟ ਗਏ ਹਨ ਕਿਉਂਕਿ ਹੁਣ ਨਾ ਕੋਈ ਕਿਸੇ ਨਾਲ ਆਪਣੀ ਗੱਲਾਂ ਗੱਲਾਂ ਹੁਣ ਨਾ ਕੋਈ ਕਿਸੇ ਨਾਲ ਆਪਣੀ ਗੱਲਾਂ ਸ਼ੇਅਰ ਕਰਦਾ ਹੈ ਅਤੇ ਨਾ ਹੀ ਕੁਛ ਨਾ ਹੀ ਪਰਿਵਾਰ ਨਾਲ ਜ਼ਿਆਦਾ ਸਮਾਂ ਬਿਤਾਉਂਦਾ ਹੈ ਕਿਉਂਕਿ ਅੱਜਕੱਲ੍ਹ ਲੋਕ ਇਕੱਲੇ ਰਹਿਣਾ ਗਿੱਝ ਗਏ ਹਨ ਅਤੇ ਉਨ੍ਹਾਂ ਕਿਉਂਕਿ ਉਨ੍ਹਾਂ ਕੋਲ਼ ਮੋਬਾਇਲ ਫੋਨ ਹਨ ਇਸ ਲਈ ਇਸ ਲਈ ਪਰਿਵਾਰਕ ਸੰਬੰਧ ਵੀ ਦਿਨੋ ਦਿਨ ਘੱਟਦੇ ਜਾ ਰਹੇ ਹਨ ਇਸ ਦਾ ਮੇਨ ਇਸ ਦਾ ਵੱਡਾ ਕਾਰਨ ਹੈ ਤਕਨਾਲੋਜੀ